ਹੈਲੋ ਸਤਿ ਸ਼੍ਰੀ ਅਕਾਲ ਮੈਮ ਕਿੱਦਾਂ ਮੈਮ ਹਾਂਜੀ ਹਾਂ ਵਧੀਆ ਮੈਮ

ਅਸੀਂ ਜੀ ਪੰਜਾਬ ਤੋਂ ਬੋਲਦੇ ਸੀ ਜੀ ਹਾਂਜੀ ਮੈਮ ਅਸੀਂ ਸੋਅ ਬੁਕਿੰਗ ਕਰਾਉਣਾ ਸੀ ਹਾਂਜੀ ਸਾਨੂੰ ਤੁਹਾਡੇ ਸੌਂਗ ਵਧੀਆ ਲੱਗੇ ਇਸ ਲਈ ਅਸੀਂ ਸੋਅ ਬੁਕਿੰਗ ਕਰਾਉਣਾ ਸੀ ਹਾਂਜੀ ਮੈਮ ਪੰਦਰ੍ਹਾਂ ਪੰਦਰ੍ਹਾਂ ਤਰੀਕ ਤੱਕ ਫਰੀ ਹੋਉਂਗੇ ਜੀ ਤੁਸੀਂ ਅੱਛਾ ਮੈਮ ਅਤੇ ਕਦੋਂ ਫਰੀ ਹੋ ਸਕਦੇ ਹੋ ਤੁਸੀਂ ਅਸੀਂ ਪੰਜਾਬ 'ਚ ਕਰਾਉਣਾ ਜੀ ਹਾਂਜੀ ਹਾਂਜੀ ਹਾਂ ਮੈਮ ਹਾਂਜੀ ਹਾਂ ਤੁਸੀਂ ਉਹਨਾਂ ਦੀ ਟੈਂਸ਼ਨ ਨਾ ਲਓ ਅਸੀਂ ਉਹ ਸਾਡਾ ਅਰੇਂਜਮੈਂਟ ਕਰਕੇ ਰੱਖਾਂਗੇ

ਨਹੀਂ ਨਹੀਂ ਮੈਮ ਉਹ ਉਹ ਅਸੀਂ ਆਪੇ ਦੇਖਾਂਗੇ ਜੀ ਹਾਂਜੀ ਹਾਂਜੀ ਮੈਮ ਤੁਹਾਡਾ ਕਿੰਨਾਂ ਕੁ ਖਰਚਾ ਆ ਜੂ ਜੀ ਬੁਕਿੰਗ 'ਤੇ ਪੰਜਾਹ ਜੀ ਅੱਛਾ ਮੈਮ ਲੈਸ ਨਹੀਂ ਹੋ ਸਕਦਾ ਥੋੜ੍ਹਾ ਅੱਛਾ ਜੀ ਠੀਕ ਹੈ ਮੈਮ ਅਤੇ ਮੈਮ ਫਿਰ ਕਦੋਂ ਫਰੀ ਹੋ ਸਕਦੇ ਤੁਸੀਂ

ਠੀਕ ਹੈ ਮੈਮ ਓਕੇ ਮੈਮ ਬਾਏ